ਅੱਜ ਕੱਲ੍ਹ ਬੱਚੇ ਮੋਬਾਇਲ ਗੇਮਿੰਗ ਦੇ ਉਭਾਰ ਨੇ ਵਿਚ ਇੰਨੇ ਕੁ ਰੁੱਝੇ ਹੋਏ ਨੇ ਕਿ ਉਹਨਾਂ ਨੂੰ ਆਪਣੀ ਸਿਹਤ ਦਾ ਨਾ ਖਿਆਲ ਹੁੰਦਿਆਂ ਹੋਇਆ ਵੀ ਉਹ ਮੋਬਾਈਲ 'ਤੇ ਗੇਮਾਂ ਖੇਡਦੇ ਰਹਿੰਦੇ ਨੇ ਔਰ ਇਸ ਗੇਮਾਂ ਦੇ ਨਾਲ ਜਿਸ ਨੇ ਵੀ ਗੇਮ ਬਣਾਈ ਹੁੰਦੀ ਹੈ ਉਸ ਦੇ ਉਦਯੋਗ ਨੂੰ ਬਹੁਤ ਹੀ ਜ਼ਿਆਦਾ ਮੁਨਾਫ਼ਾ ਹੁੰਦਾ ਹੈ ਪਰ ਜਿਸ ਕ ਤਰ੍ਹਾਂ ਸੋਚਿਆ ਜਾਵੇ ਕਿ ਬੱਚਿਆਂ ਦੀ ਇਸ ਦੇ ਨਾਲ ਗਰੋਥ ਰੁੱਕ ਗਈ ਹੈ ਕਿਉਂਕਿ ਬੱਚੇ ਬੈਠ ਕੇ ਗੇਮਾਂ ਦੇ ਵਿੱਚ ਲੱਗੇ ਰਹਿੰਦੇ ਨੇ ਉਹਨਾਂ ਦੀਆਂ ਅੱਖਾਂ 'ਤੇ ਅਸਰ ਪੈਂਦਾ ਈਵਨ ਨਵਸ 'ਤੇ ਅਸਰ ਪੈਂਦਾ ਪਰ ਉਹ ਇਸ ਗੱਲ ਨੂੰ ਨਾ ਸੋਚਦੇ ਹੋਏ ਆਪਣੀ ਹੈਲਥ ਨੂੰ ਇੱਕ ਪਾਸੇ ਰੱਖਦੇ ਹੋਏ ਉਹ ਆਪਣੇ ਮੋਬਾਈਲ ਗੇਮਾਂ ਦੇ ਵਿੱਚ ਹੀ ਫਸੇ ਰਹਿੰਦੇ ਨੇ ਇਸ ਦੇ ਨਾਲ ਸਰਕਾਰ ਨੂੰ ਵੀ ਬਹੁਤ ਫ਼ਾਇਦਾ ਹੁੰਦਾ ਕਿਉਂਕਿ ਸਰਕਾਰ ਨੇ ਹੀ ਉਦੋਗੀਕਰਨ ਕੀਤਾ ਹੋਇਆ ਉਹਨਾਂ ਨੂੰ ਇਸ ਦੇ ਨਾਲ ਕਾਫ਼ੀ ਪੈਸਾ ਵੀ ਮਿਲਦਾ ਪਰ ਬੱਚੇ ਇੱਕ ਸੌ ਪੰਜਾਹ ਕਰੋੜ ਦੀ ਪਾਪੂਲੇਸ਼ਨ ਜਿਹੜੀ ਕਿ ਮੋਬਾਈਲ ਵਰਤ ਰਹੀ ਹੈ ਉਹਦੇ ਨਾਲ ਕਈਆਂ ਬੱਚਿਆਂ ਦੀ ਫਿਜੀਕਲ ਹੈਲਥ 'ਤੇ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਪਰ ਕਈ ਬੱਚੇ ਇਸ ਨੂੰ ਇੱਕ ਸਿਰਫ਼ ਗੇਮ ਦੇ ਤੌਰ 'ਤੇ ਲੈ ਕੇ ਕੁਝ ਸਮਾਂ ਖੇਡ ਕੇ ਆਪਣਾ ਇੰਜੋਇਮੈਂਟ ਕਰਦੇ ਨੇ ਪਰ ਜਿਹੜੇ ਬੱਚੇ ਰੈਗੂਲਰ ਇਹਨਾਂ ਗੇਮਾਂ ਨੂੰ ਖੇਡਦੇ ਨੇ ਉਹਨਾਂ ਨੂੰ ਨੁਕਸਾਨ ਵੀ ਹੋ ਜਾਂਦਾ ਹੈ ਅਤੇ ਸਾਨੂੰ ਓ ਸਰਕਾਰ ਨੂੰ ਚਾਹੀਦਾ ਕਿ ਇਸ ਗੇਮ ਨੂੰ ਕੁਝ ਸਮੇਂ ਵਾਸਤੇ ਦਿਨ ਦੇ ਵਿੱਚ ਸਟੋਪਿਜ਼ ਲਗਾਉਣਾ ਚਾਹੀਦਾ ਕਿ ਬੱਚੇ ਉਦੋਂ ਆਪਣੀਆਂ ਆਊਟਰ ਗੇਮ ਦੇ ਵਿੱਚ ਵੀ ਜਾ ਕੇ ਆਪਣੀ ਫਿਜੀਕਲ ਹੈਲਥ ਨੂੰ ਵੀ ਇੰਪਰੂਵ ਕਰ ਸਕਣ